ਸ ਸਿੱਖਿਆ ਪ੍ਰਣਾਲੀ ਕਿਸੇ ਵੀ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ ਇਹ ਇੰਪਰੂਵਡ ਹੋਣੀ ਜ਼ਰੂਰੀ ਹੈ ਅਤੇ ਸਿੱਖਿਆ ਪ੍ਰਣਾਲੀ ਵਿੱਚ ਇੰਪੋਰਟੈਂਟ ਹੈ ਕਿਉਂਕਿ ਇਸ ਏ ਇੰਡੀਵਿਜੁਅਲ ਨੂੰ ਇਹ ਜਨਰਲ ਨੋਲਜ ਦਿੰਦੀ ਹੈ ਅਤੇ ਸਕਿੱਲ ਡਿਵੈਲਪਮੈਂਟ ਵਿੱਚ ਮਦਦ ਕਰਦੀ ਹੈ ਅਤੇ ਸਿੱਖਿਆ ਪ੍ਰਣਾਲੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਨਾਲ਼ ਬੰਦੇ ਦੀ ਪਰਸਨਲ ਅਤੇ ਪ੍ਰੋਫੈਸ਼ਨਲ ਗਰੋਥ ਵੀ ਹੁੰਦੀ ਹੈ ਇਹ ਇਸ ਨਾਲ਼ ਏ ਬੰਦੇ ਨੂੰ ਸ਼ੋਸ਼ਲਾਇਜ਼ ਹੋਣ ਵਿੱਚ ਮਦਦ ਮਿਲਦੀ ਹੈ ਬੰਦਾ ਸੌਖੇ ਤਰੀਕੇ ਨਾਲ਼ ਸ਼ੋਸ਼ਲਾਇਜ਼ ਹੋ ਸਕਦਾ ਏ ਆ ਅਤੇ ਦੇਸ਼ ਦੀ ਈਕੋਨਮੀ ਵਿੱਚ ਇਹ ਵੀ ਇੰਮਪਰੂਵਮੈਂਟ ਹੁੰਦੀ ਹੈ ਅਤੇ ਸ ਸਿੱਖਿਆ ਨੂੰ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਐਜੂਕੇਸ਼ਨ ਨੂੰ ਲੈ ਜਾਣ ਨਾਲ਼ ਸਾਡੇ ਸੱਭਿਆਚਾਰ ਦੀ ਸਾਡੇ ਸੱਭਿਆਚਾਰ ਦੀ ਰਿਪਰਜ਼ੈਂਟੇਸ਼ਨ ਵੀ ਹੁੰਦੀ ਹੈ ਅਤੇ ਇਸ ਨਾਲ਼ ਬੰਦੇ ਦੀ ਪ੍ਰਸਨਲ ਗਰੋਥ ਵੀ ਹੁੰਦੀ ਹੈ ਪ੍ਰਸਨਲ ਗਰੋਥ ਵੀ ਹੋ ਸਕਦੀ ਹੈ ਅਤੇ ਬੰਦਾ ਆਪਣੇ ਰੋਜ਼ੀ ਰੋਟੀ ਲਈ ਵੀ ਇੱਕ ਰੋਜ਼ ਡੇਲੀ ਲਈ ਵੀ ਆਪਣੇ ਖਰਚਾ ਪਾਣੀ ਕੱਢਣ ਲਈ ਵੀ ਜੋ ਕਿ ਬਹੁਤ ਜ਼ਰੂਰੀ ਹੈ ਉਸ ਲਈ ਬੜਾ ਜ਼ਰੂਰੀ ਹੈ ਉਹ ਕਰ ਸਕਦਾ ਹੈ ਅਤੇ ਸਰਕਾਰ ਇਹ ਕਰ ਸਰਕਾਰ ਪੇਂਡੂ ਇਲਾਕਿਆਂ ਵਿੱਚ ਪੇਂਡੂ ਖੇਤਰਾਂ ਵਿੱਚ ਬੇਹਤਰ ਕਰਨ ਲਈ ਕਾਫ਼ੀ ਕੁਝ ਕਰ ਸਕਦੀ ਹੈ ਸਰਕਾਰ ਟੀਚਰਾਂ ਨੂੰ ਟ੍ਰੇਨਿੰਗ ਦੇਵੇ ਤਾਂ ਕਿ ਸਰਕਾਰ ਟੀਚਰਾਂ ਨੂੰ ਟ੍ਰੇਨਿੰਗ ਟ੍ਰੇਨਿੰਗ ਦੇਵੇ ਤਾਂ ਕਿ ਉਹ ਜ ਵਧੀਆ ਤੱਕ ਪੜ੍ਹਾ ਸਕਣ ਅਤੇ ਚੰਗੀ ਐਜੂਕੇਸ਼ਨ ਬੱਚਿਆਂ ਨੂੰ ਮਿਲ ਸਕੇ ਅਤੇ ਸਰਕਾਰ ਇਹ ਵੀ ਕਰੇ ਕਿ ਟਰਾਂਸਪੋਟੇਸ਼ਨ ਵਿੱਚ ਵੀ ਪੈਸਾ ਲਗਾਵੇ ਤਾਂ ਕਿ ਚੰਗੀਆਂ ਬੱਸਾਂ ਚੰਗੇ ਆਉਣ ਜਾਣ ਦੇ ਸਾਧਨ ਹੋਣ ਅਤੇ ਇਹ ਬੱਚਿਆਂ ਨੂੰ ਸੌਖਾ ਸੌਖੇ ਤਰੀਕੇ ਨਾਲ਼ ਸਕੂਲ ਪਹੁੰਚ ਸਕਣ ਸਕੂਲ ਦਾ ਇੰਨਫ਼ਰਾ ਇੰਫਰਾਸਟਰਕਚਰ ਵਿੱਚ ਬਿਲਡਿਗਾਂ ਵਧਾਉਣ ਬਾਥਰੂਮ ਕਲਾਸਰੂਮ ਉਹਨਾਂ ਵਿੱਚ ਵੀ ਜ਼ਿਆਦਾ ਇੰਨਵੈਸਟ ਕਰਨਾ ਚਾਹੀਦਾ ਸਰਕਾਰ ਨੂੰ ਪੇਂਡੂ ਇਲਾਕਿਆਂ ਵਿੱਚ ਕਿਉਂਕਿ ਉਸ ਨਾਲ਼ ਜਿੰਨੀਆਂ ਵਧਣਗੀਆਂ ਵਧਣ ਇਸ ਵਿੱਚ ਇੰਮਪੂਰਵਮੈਂਟ ਹੋਵੇਗੀ ਤਾਂ ਜ਼ਿਆਦਾ ਐਡਮਿਸ਼ਨ ਹੋਣਗੇ ਬੱਚੇ ਦੀਆਂ ਅਤੇ ਇਹ ਸਟੇਟ ਦਾ ਐਜੂਕੇਸ਼ਨ ਲੈਵਲ ਵੀ ਵਧੇਗਾ ਉਸ ਤੋਂ ਇਲਾਵਾ ਇਹ ਕੋਂਪੀਟੀਸ਼ਨ ਬੱਚਿਆਂ ਨੂੰ ਕੋਂਪੀਟੀਸ਼ਨ ਜ਼ਿਆਦਾ ਕਰਵਾਉਣੇ ਚਾਹੀਦੇ ਹਨ ਸਰਕਾਰ ਨੂੰ ਉਸ ਵਿੱਚ ਪੈਸਾ ਲਗਾਉਣਾ ਚਾਹੀਦਾ ਹੈ ਕਿਉਂਕਿ ਉਸ ਨਾਲ਼ ਬੱਚਿਆਂ 'ਚ ਕੋਂਪੀਟੀਸ਼ਨ ਹੋਵੇਗਾ ਤਾਂ ਉਹਨਾਂ 'ਚ ਇੱਕ ਇੰਸਪੀਰੇਸ਼ਨ ਮਿਲੂਗੀ ਅੱਗੇ ਵੱਧਣ ਦੀ ਸਰਕਾਰ ਨੂੰ ਇਹ ਹਰ ਸਕੂਲ ਵਿੱਚ ਮਿਡ ਡੇ ਮੀਲ ਕਰਾਉਣਾ ਚਾਹੀਦਾ ਹੈ ਮਿਡ ਡੇ ਮੀਲ ਤਾਂ ਕਿ ਬੱਚਿਆਂ ਨੂੰ ਚੰਗੀ ਸਿਹਤ ਮਿਲ ਸਕੇ ਚੰਗੀ ਸਿਹਤ ਮਿਲ ਸਕੇ ਅਤੇ ਕੋਈ ਬੀਮਾਰੀ ਵਗੈਰਾ ਕੋਈ ਮਲਫੰਕਸ਼ਨ ਨਾ ਹੋਵੇ ਅਤੇ ਚੰਗੀ ਸਕੂਲਿੰਗ ਹੋਵੇ